ਹੈਲੋ ਹਾਂਜੀ ਐਮਾਜ਼ੋਨ ਅੱਛਾ ਲਾਸ਼ਟ ਵੀਕ ਨਾ ਮੈਂ ਤੁਹਾਡੇ ਉਹ ਤੋਂ ਸਾਈਟ ਤੋਂ ਕੀਤਾ ਸੀਗਾ ਇੱਕ ਪੋ ਲੈਪਟਾਪ ਕੀਤਾ ਸੀਗਾ ਸੋਨੀ ਦਾ ਅਤੇ ਉਹ ਬੜਾ ਵਧੀਆ ਲੱਗਿਆ ਮੈਨੂੰ ਅਤੇ ਜਦੋਂ ਮੈਂ ਉਸ ਦੀ ਪੈਕਿੰਗ ਖੋਲ੍ਹੀ ਉਹਦੀ ਉਸਦੀ ਪੈਕਿੰਗ ਸੀਗੀ ਜਿਹੜੀ ਐਨੀ ਬੜੀ ਜ਼ਬਰਦਸਤ ਸੀ ਨਾ ਮਤਲਬ ਕਿ ਉਹ ਪੂਰਾ ਸੇਫਟਲੀ ਪੈਕ ਕੀਤਾ ਹੋਇਆ ਸੀ ਜੇਕਰ ਕੋਈ ਮਿਸਹੈਪਨਿੰਗ ਹੁੰਦੀ ਹੈ ਤਾਂ ਉਹ ਬਹੁਤ ਵਧੀਆ ਸੀਗਾ ਅਤੇ ਜਦੋਂ ਮੈਂ ਪੈਕਿੰਗ ਖੋਲ੍ਹੀ ਉਸਦੀ ਤਾਂ ਉਸਦਾ ਜਿਹੜਾ ਕਲਰ ਸੀਗਾ ਉਹ ਬੜਾ ਵਧੀਆ ਸੀਗਾ ਅਤੇ ਉਹ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ